ਔਟਵਗੋਲੀ ਸੂਰਜ ਨੂੰ ਪਾਣੀ ਪੜਾਉਣਾ ਮੱਥੇ 'ਤੇ ਸਿੰਦੂਰ ਪਵਿੱਤਰ ਧਾਗਾ ਪਾਉਣਾ ਉਹਦਾ ਲਈ ਮੰਦਰ ਜਾਣਾ ਦਰਗਾਹ 'ਤੇ ਜਾਣਾ ਇੱਦਾਂ ਦੀਆਂ ਸਾਰੀਆਂ ਧਾਰਮਿਕ ਰੀਤਾਂ ਹੈ ਜੋ ਆਪਣੇ ਆਪ 'ਚ ਹੀ ਮਹੱਤਵ ਹੈ ਜਦੋਂ ਮੱਥੇ 'ਤੇ ਸੰਧੂਰ ਲੱਗਦਾ ਪਵਿੱਤਰ ਧਾਗਾ ਪਾਉਂਦੇ ਤਾਂ ਸਾਨੂੰ ਲੱਗਦਾ ਕਿ ਸਾਡੇ ਨਾਲ ਹੈ ਰੱਬ ਅਸੀਂ ਮੰਦਰ 'ਚ ਜਾ ਕੇ ਪੂਜਾ ਕਰਦੇ ਦਰਗਾਹਾਂ 'ਤੇ ਜਾਂਦੇ ਸਕੂਨ ਮਿਲਦਾ ਇੱਕ ਤਰ੍ਹਾਂ ਨਾਲ ਸਾਨੂੰ ਵਰਤ ਰੱਖਦੇ ਰੋਜਾ ਰੱਖਦੇ ਧਾਰਮਿਕ ਰੀਤਾਂ ਇਹਨਾਂ ਦਾ ਆਪੋ ਆਪਣਾ ਮਹੱਤਵ ਹੈ ਸਾਡੇ ਸਭਿਆਚਾਰ ਵਿੱਚ ਸਾਡੇ ਸੱਭਿਆਚਾਰ ਵਿੱਚ ਇੱਕ ਪਵਿੱਤਰ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਤਾਂਕਿ ਜੋ ਇਹ ਸਾਰਾ ਕੁਝ ਲੋਕਾਂ ਨੂੰ ਪਤਾ ਲੱਗ ਸਕੇ